ਪੰਜਾਬ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਇੱਥੇ ਪੰਜ ਦਰਿਆ ਵਗਦੇ ਨੇ ਅਤੇ ਇਨ੍ਹਾਂ ਦਰਿਆਵਾਂ ਨੂੰ ਮੁੱਖ ਰੱਖਿਆ ਗਿਆ ਅਤੇ ਜੇ ਅਸੀਂ ਪੰਜਾਬ ਦੇ ਮੁੱਖ ਖੇਤਰਾਂ ਦੀ ਗੱਲ ਕਰੀਏ ਵਿਸ਼ੇਸ਼ਤਾ ਦੀ ਗੱਲ ਕਰੀਏ ਤਾਂ ਇੱਥੇ ਨੇੜਲੇ ਲੱਗਦੇ ਇਲਾਕੇ ਜਿਸ ਤਰ੍ਹਾਂ ਹਿਮਾਚਲ ਦੀ ਗੱਲ ਕਰੀਏ ਇੱਥੇ ਸੁੰਦਰ ਪਹਾੜੀਆਂ ਅਤੇ ਉਨ੍ਹਾਂ ਦੇ ਕਰਕੇ ਜਿਹੜਾ ਪੰਜਾਬ ਦਾ ਮੌਸਮ ਆ ਬਹੁਤ ਹੀ ਰੋਮਾਂਚਕ ਹੀ ਕਹਾਂਗੀ ਕਿਉਂਕਿ ਇੱਥੇ ਗਰਮੀ ਵੀ ਪੂਰੀ ਪੈਂਦੀ ਹੈ ਅਤੇ ਸਰਦੀਆਂ ਵੀ ਪੂਰੀਆਂ ਹੁੰਦੀਆਂ ਜਿਨ੍ਹਾਂ ਦਾ ਮਜ਼ਾ ਲੈਣ ਵਾਸਤੇ ਲੋਕ ਦੂਰੋਂ ਦੂਰੋਂ ਵੀ ਆਉਂਦੇ ਨੇ ਜਿਸ ਹਿਸਾਬ ਦੇ ਨਾਲ ਇੱਥੇ ਕਈ ਜਗ੍ਹਾ ਵੀ ਹੈਗੀਆਂ ਜਿਸ ਤਰ੍ਹਾਂ ਡਲਹੌਜ਼ੀ ਸ਼ਿਮਲਾ ਜਾਂ ਪੰਜਾਬ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਇਹ ਜੋ ਸ਼ਹਿਰ ਨੇ ਇਹ ਕਾਫ਼ੀ ਸੋਹਣੇ ਬਣੇ ਹੋਏ ਨੇ ਅਤੇ ਲੋਕਾਂ ਨੂੰ ਅਟ੍ਰੈਕਟ ਕਰਦੇ ਨੇ ਇੱਥੇ ਆਉਣ ਵਾਸਤੇ ਅਤੇ ਲੋਕ ਆ ਕੇ ਐਨਾ ਗਰਮ ਅਤੇ ਠੰਢ ਦਾ ਮਜ਼ਾ ਲੈਂਦੇ ਨੇ